ਤੁਹਾਨੂੰ ਮੈਂ ਅੱਜ ਦੱਸਣਾ ਚਾਹੁੰਦਾ ਹਾਂ ਵੀ ਹਾ ਇੱਕ ਹਾ ਮੇਰੇ ਨਾਲ ਕਿਹੜੀ ਯਾਦਗਾਰ ਦੀ ਘਟਨਾ ਵਾਪਰੀ ਹੈ ਮੈਂ ਤੁਹਾਨੂੰ ਜਿਵੇਂ ਦੱਸਣਾ ਵੀ ਹਰ ਸਾਲ ਅਸੀਂ ਮੈਂ ਦਿਵਾਲੀ 'ਤੇ ਕੋਈ ਨਾ ਕੋਈ ਲੋਟਰੀ ਪਾਉਂਦਾ ਰਹਿੰਦਾ ਹਾਂ ਪਰ ਪਿਛਲੇ ਕਈ ਸਾਲਾਂ ਤੋਂ ਮੇਰੀ ਕਿਸਮਤ ਦਾ ਕੁਛ ਵੀ ਨਹੀਂ ਲੱਗਾ ਜਿਵੇਂ ਕਹਿ ਸਕਦੇ ਹਾਂ ਜੀਰੋ ਸ਼ੂਨਿਆ ਕੁਛ ਹਾਂ ਲੱਗਾ ਪਰ ਪਿਛਲੇ ਸਾਲ ਹੀ ਮੈਂ ਫਿਰ ਦਿਵਾਲੀ 'ਤੇ ਆਪਣੀ ਲੋਟਰੀ ਦੀ ਟਿਕਟ ਪਾਈ ਅਤੇ ਜਿਹਦੇ ਵਿੱਚ ਮੈਨੂੰ ਪੈਂਤੀ ਲੱਖ ਦੀ ਟਿਕਟ ਦਾ ਇਨਾਮ ਨਿਕਲਿਆ ਸੀ ਹਾਂਜੀ ਅਤੇ ਉਹਦੇ ਵਿੱਚ ਉਹ ਕੰਪਨੀ ਵਾਲੇ ਨੇ ਫਿਰ ਮੈਨੂੰ ਫੋਨ ਕੀਤਾ ਵੀ ਇੱਦਾਂ ਤੁਹਾਡੀ ਪੈਂਤੀ ਲੱਖ ਰੁਪਈਏ ਦੀ ਗੱਡੀ ਨਿਕਲੀ ਆ ਅਤੇ ਇਸ ਕਰਕੇ ਤੁਸੀਂ ਲੈ ਜਾਓ ਪਰ ਫਿਰ ਮੈਂ ਕਿਹਾ ਵੀ ਸਾਡਾ ਘਰ ਦੇ ਵਿੱਚ ਗੱਡੀ ਲਾਉਣ ਦੀ ਇੰਨੀ ਕੁ ਜ਼ਿਆਦਾ ਤਾਂ ਹੈਗੀ ਨਹੀਂ ਹੀ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਨਹੀਂ ਗੱਡੀ ਲਾਉਣ ਦੀ ਸਾਡੇ ਘਰ ਜਗ੍ਹਾ ਹੈਗੀ ਨਹੀਂ ਇਹ ਤੁਸੀਂ ਰੱਖ ਲਓ ਆਪਣੇ ਕੋਲ ਅਤੇ ਮੈਨੂੰ ਪੈਸੇ ਦੇ ਸਕਦੇ ਨੋਟ ਹੈਗੇ ਅਤੇ ਉਹ ਦੇ ਦੋ ਫਿਰ ਉਹਨਾਂ ਨੇ ਪੰਜ ਲੱਖ ਰੁਪਿਆ ਇਹਦੇ ਵਿੱਚੋਂ ਕੱਟ ਲਿਆ ਅਤੇ ਤੀਹ ਲੱਖ ਰੁਪਿਆ ਉਹਨਾਂ ਨੇ ਮੈਨੂੰ ਦੇ ਦਿੱਤਾ ਵਾਪਸ ਹਾਂਜੀ ਚੈੱਕ ਦੇਤਾ ਅਤੇ ਉਹਦੇ ਵਿੱਚੋਂ ਮੈਂ ਖੁਸ਼ ਹਾਂ ਅਤੇ ਉਹਦੇ ਵਿੱਚੋਂ ਆਪਣਾ ਥੋੜ੍ਹਾ ਜਿਹਾ ਘਰ ਬਾਹਰ ਦਾ ਕੋਠੀ ਕੋਠਾ ਛੱਤ ਲਿਆ ਹਾਂਜੀ ਦੋ ਮੰਜ਼ਿਲ ਪਾ ਲਈ ਅਤੇ ਨਾਲ ਥੋੜ੍ਹਾ ਜਿਹਾ ਆਪਣਾ ਮੈਂ ਬਿਜ਼ਨਸ ਵਧਾ ਲਿਆ ਜਿਹਦੇ ਵਿੱਚ ਮੈਂ ਟੈਂਟ ਹਾਊਸ ਵਾਲਿਆਂ ਨਾਲ ਡੀ ਜੇ ਪਾ ਲਏ ਜਿਹਦੇ ਨਾਲ ਹੁਣ ਮੇਰਾ ਵਪਾਰ ਥੋੜ੍ਹਾ ਜਿਹਾ ਚੰਗਾ ਚੱਲਣ ਦਿਆ ਅਤੇ ਮੈਂ ਨਾਲ ਹੁਣ ਟੈਂਟ ਦਾ ਕੰਮ ਕਰਦਾ ਹਾਂਜੀ ਥੈਂਕ ਯੂ